ਕੁਝ ਕਾਨੂੰਨੀ ਦਸਤਾਵੇਜ਼ ਬਣਾਉਣੇ ਬਹੁਤ ਮੁਸ਼ਕਿਲ ਹੁੰਦੇ ਹਨ ਜਿਵੇਂ ਕਿ ਆਧਾਰ ਕਾਰਡ ਵਿੱਚ ਕੋਈ ਕੁਰੈਕਸ਼ਨ ਕਰਵਾਉਣੀ ਇਨਕਮ ਸਰਟੀਫਿਕੇਟ ਬਣਾਉਣੇ ਕੋਈ ਰਜਿਸਟਰੀ ਦਾ ਕੰਮ ਕਰਵਾਉਣਾ ਅਤੇ ਹੋਰ ਕਈ ਤਰ੍ਹਾਂ ਦੇ ਡਾਕੂਮੈਂਟਸ ਜਿਨ੍ਹਾਂ ਵਿੱਚੋਂ ਮੈਂ ਆਮਦਨ ਸਰਟੀਫਿਕੇਟ ਦੀ ਗੱਲ ਕਰਨੀ ਚਾਹੁੰਦੀ ਹਾਂ ਜਿਸ ਨੂੰ ਇਨਕਮ ਸਰਟੀਫਿਕੇਟ ਵੀ ਆਖਦੇ ਹਨ ਇਸ ਨੂੰ ਬਣਾਉਣ ਲਈ ਪਹਿਲਾਂ ਸਾਨੂੰ ਇਸ ਨਾਲ ਸੰਬੰਧਿਤ ਫਾਰਮ ਭਰਨੇ ਪੈਂਦੇ ਹਨ ਅਤੇ ਕੁਛ ਜ਼ਰੂਰੀ ਦਸਤਾਵੇਜ਼ ਲਾਉਣੇ ਪੈਂਦੇ ਹਨ ਜਿਵੇਂ ਕਿ ਸੰਬੰਧਿਤ ਵਿਅਕਤੀ ਦਾ ਆਧਾਰ ਕਾਰਡ ਉਸ ਦੇ ਇਨਕਮ ਦਾ ਕੋਈ ਸਬੂਤ ਉਸਦੀ ਰਿਹਾਇਸ਼ ਦਾ ਅਤੇ ਵੋਟਰ ਆਈ ਡੀ ਦੇ ਸਬੂਤ ਆਦਿ ਫਿਰ ਇਹ ਫਾਰਮ ਭਰਨ ਉਪਰੰਤ ਸੰਬੰਧਤ ਰਿਹਾਇਸ਼ ਦੇ ਐੱਮ ਸੀ ਜਾਂ ਸਰਪੰਚ ਦੇ ਹਸਤਾਖਰਾਂ ਦੀ ਲੋੜ ਹੁੰਦੀ ਹੈ ਅਤੇ ਉਹ ਇਹ ਲਿਖਦੇ ਹਨ ਕਿ ਇਹ ਵਿਅਕਤੀ ਇਸ ਰਿਹਾਇਸ਼ ਨਾਲ ਸੰਬੰਧਿਤ ਹੈ ਅਤੇ ਇਸ ਦੀ ਸਲਾਨਾ ਆਮਦਨ ਇੰਨੀ ਹੈ ਅਤੇ ਇਸ ਤੋਂ ਉਪਰੰਤ ਫਿਰ ਪਟਵਾਰੀ ਦੇ ਸਾਈਨਜ਼ ਦੀ ਲੋੜ ਪੈਂਦੀ ਹੈ ਪਟਵਾਰੀ ਦੇ ਹਸਤਾਖਰ ਕਰਨ ਤੋਂ ਬਾਅਦ ਇਸ ਨੂੰ ਸੇਵਾ ਕੇਂਦਰਾਂ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਹੈ ਇਹ ਐਪਲੀਕੇਸ਼ਨ ਫਾਰਮ ਜਮ੍ਹਾਂ ਕਰਵਾਉਣ ਤੋਂ ਕੁਝ ਦਿਨਾਂ ਬਾਅਦ ਇਹ ਸਰਟੀਫਿਕੇਟ ਜਾਰੀ ਹੁੰਦਾ ਹੈ ਇਸ ਦੀ ਲੋੜ ਕ ਬਹੁਤ ਸਾਰੇ ਕੰਮਾਂ ਵਿੱਚ ਪੈਂਦੀ ਹੈ ਇਹ ਦਸਤਾਵੇਜ਼ ਬਣਾਉਣੇ ਬਹੁਤ ਕਠਿਨ ਹਨ ਅਤੇ ਇਹਨਾਂ ਲਈ ਬਹੁਤ ਭੱਜ ਦੌੜ ਕਰਨੀ ਪੈਂਦੀ ਹੈ ਇਹਨਾਂ ਨਾਲ ਬਹੁਤ ਸਾਰੇ ਹੋਰ ਨਿੱਜੀ ਦਸਤਾਵੇਜ਼ਾਂ ਦੀ ਲੋੜ ਵੀ ਪੈਂਦੀ ਹੈ ਦਸਤਾਵੇਜ਼ ਪ੍ਰਾਪਤ ਕਰਨ ਲਈ ਸਾਨੂੰ ਆਪਣੀ ਰਿਹਾਇਸ਼ ਦੇ ਨੇੜਲੇ ਤਹਿਸੀਲਦਾਰ ਜਾਂ ਸੰਬੰਧਿਤ ਔਫਿਸ ਵਿੱਚ ਜਾਣਾ ਪੈਂਦਾ ਹੈ ਅੱਜ ਕੱਲ੍ਹ ਇਹ ਦਸਤਾਵੇਜ਼ ਡਾਕ ਸੇਵਾਵਾਂ ਰਾਹੀਂ ਵੀ ਸੰਬੰਧਿਤ ਰਿਹਾਇਸ਼ ਦੇ ਅ ਐਡਰੈਸ 'ਤੇ ਆ ਜਾਂਦੇ ਹਨ ਕੁਝ ਦਸਤਾਵੇਜ਼ ਪ੍ਰਾਪਤ ਕਰਨੇ ਬਹੁਤ ਮੁਸ਼ਕਿਲ ਹੁੰਦੇ ਹਨ ਜਿਹਨਾਂ ਵਿੱਚ ਸੰਪੱਤੀ ਹਸਤਾਖਰ ਦਾ ਨਹੀਂ ਲਿਖਿਤ ਰੂਪ ਸਟੋਕ ਪ੍ਰਮਾਣ ਪੱਤਰ ਕੂਪਨ ਬੋਂਡ ਚੈੱਕ ਡੀਡ ਲੋਨ ਐਗਰੀਮੈਂਟ ਆਰਟੀਕਲਸ ਔਫ ਐਸੋਸੀਏਸ਼ਨ ਬਿ ਬਿਜਨਸ ਅਸ ਐਗਰੀਮੈਂਟ ਅਸਾਈਨਮੈਂਟ ਔਫ ਪਾਰਟਨਰਸ਼ਿਪ ਇੰਟਰਸਟ ਆਦਿ ਸ਼ਾਮਿਲ ਹਨ ਇਹ ਦਸਤਾਵੇਜ਼ ਪ੍ਰਾਪਤ ਕਰਨੇ ਬਹੁਤ ਔਖੇ ਹੁੰਦੇ ਹਨ ਅਤੇ ਇਹਨਾਂ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਧੰਨਵਾਦ